ਪੰਜਾਬੀ ਸਾਡੀ ਮਾਂ ਬੋਲੀ ਹੈ ਅਤੇ ਸਾਨੂੰ ਪੰਜਾਬੀ ਬੋਲਣਾ ਵੀ ਚੰਗਾ ਲੱਗਦਾ ਹੈ ਅਤੇ ਲੇਕਿਨ ਜਦੋਂ ਅਸੀਂ ਪੜ੍ਹਾਈ ਲਿਖਾਈ ਕਰਦੇ ਹਾਂ ਅਤੇ ਸਾਨੂੰ ਸਾਰੀਆਂ ਭਾਸ਼ਾਵਾਂ ਜਿਵੇਂ ਕਿ ਅੰਗਰੇਜ਼ੀ ਹਿੰਦੀ ਵੀ ਪੜ੍ਹਣੀਆਂ ਪੈਂਦੀਆਂ ਹਨ ਅਤੇ ਕੰਪਲਸਰੀ ਜ਼ਰੂਰੀ ਹੋ ਜਾਂਦੀਆਂ ਹਨ ਅਤੇ ਇੱਕ ਵਾਰ ਦਾ ਮੇਰਾ ਅਨੁਭਵ ਹੈ ਕਿ ਮੈਂ ਮੀਨਸ ਜਿਵੇਂ ਹਿੰਦੀ ਦਾ ਐਸੇ ਲੇਖ ਲਰਨ ਕੀਤਾ ਯਾਦ ਕੀਤਾ ਅਤੇ ਮੈਨੂੰ ਟੀਚਰ ਕਹਿੰਦੇ ਕਿ ਕੀ ਤੁਸੀਂ ਇਸਨੂੰ ਪੰਜਾਬੀ ਦੇ ਵਿੱਚ ਚੇਂਜ ਕਰ ਸਕਦੇ ਹੋ ਬਦਲ ਸਕਦੇ ਹੋ ਤਾਂ ਮੇਰਾ ਅਨੁਭਵ ਕਾਫ਼ੀ ਚੰਗਾ ਰਿਹਾ ਮੈਨੂੰ ਚੇਂਜ ਕਰਨਾ ਕਿ ਜੇ ਉਸ ਐਸੇ ਨੂੰ ਲੇਕਿਨ ਹਿੰਦੀ ਦੇ ਜਿਹੜੇ ਵਰਡ ਸ਼ਬਦ ਹੁੰਦੇ ਹਨ ਉਹ ਥੋ ਥੋੜ੍ਹੇ ਪੰਜਾਬੀ ਤੋਂ ਵੱਖਰੇ ਹੀ ਹੁੰਦੇ ਹਨ ਜੈਸੇ ਤੁਸੀਂ ਕਹਿ ਦਿੰਦੇ ਹਾਂ ਅਤੇ ਉਹ ਆਪ ਆ ਜਾਂਦਾ ਹੈ ਅਸੀਂ ਤੂੰ ਕਹਿੰਦੇ ਹਾਂ ਅਤੇ ਤੂੰ ਆ ਜਾਂਦਾ ਹੈ ਅਤੇ ਜਿਹੜੀ ਪੰਜਾਬੀ ਭਾਸ਼ਾ ਹੈ ਉਹ ਇੱਕ ਆਪਣਾਪਨ ਸਾਹਮਣੇ ਵਾਲੇ ਨੂੰ ਪੇਸ਼ ਕਰ ਦਿੰਦੀ ਹੈ ਅਤੇ ਕਾਫ਼ੀ ਮਿੱਠੀ ਬੋਲੀ ਹੈ ਅਤੇ ਮੇਰਾ ਅਨੁਭਵ ਵੀ ਕਾਫ਼ੀ ਚੰਗਾ ਰਿਹਾ ਹੈ ਨਾ ਅਤੇ ਉਹ ਲੇਖ ਨੂੰ ਜਦੋਂ ਮੈਂ ਪਹਿਲੇ ਹਿੰਦੀ 'ਚ ਲਿਖਿਆ ਹੋਇਆ ਸੀ ਅਤੇ ਜ ਇੱਕ ਜਿਵੇਂ ਲੱਗਦਾ ਸੀ ਕਿ ਇੱਕ ਆਪਣਾ ਨਿਯਮਿਤ ਜਿਹਾ ਹੈਗਾ ਇੱਕ ਕੰਮ ਪੜ੍ਹਾਈ ਲਿਖਾਈ ਦਾ ਜਿਹੜਾ ਅਸੀਂ ਕਰਦੇ ਕੋਪੀ 'ਤੇ ਲਿਖਣਾ ਅਤੇ ਉਹਨੂੰ ਯਾਦ ਕਰਨਾ ਲੇਕਿਨ ਜਦੋਂ ਉਹਨੂੰ ਮੈਂ ਪੰਜਾਬੀ 'ਚ ਅਨੁਵਾਦ ਕੀਤਾ ਤਾਂ ਮੈਨੂੰ ਲੱਗਿਆ ਕਿ ਜਿਵੇਂ ਆਪਣਾ ਇੱਕ ਨਿੱਜੀ ਜ਼ਿੰਦਗੀ 'ਤੇ ਹੀ ਉਹ ਲਾਗੂ ਹੋਣ ਵਾਲੀ ਚੀਜ਼ ਹੈ ਅਤੇ ਕੁਛ ਕਈ ਸ਼ਬਦ ਆਪਣੇਪਨ ਦੇ ਵਿੱਚ ਯੂਜ ਹੁੰਦੇ ਹਨ ਉਹ ਐਸੇ ਮੇਰਾ ਮਿੱਤਰ ਸੀ ਅਤੇ ਕਾਫ਼ੀ ਚੰਗਾ ਅਨੁਭਵ ਰਿਹਾ ਮੇਰਾ ਪੰਜਾਬੀ 'ਚ ਉਹਨੂੰ ਅਨੁਵਾਦ ਕਰਨਾ ਅਤੇ ਐਵੇਂ ਲੱਗੇ ਕਿ ਜਿਵੇਂ ਇੱਕ ਬਿਲਕੁਲ ਰੀਅਲ ਲਾਈਫ ਹਰ ਇੱਕ ਜ਼ਿੰਦਗੀ ਵਿੱਚ ਹੀ ਅਸੀਂ ਇਹਨੂੰ ਫੀਲ ਕਰ ਰਹੇ ਹਾਂ ਮਹਿਸੂਸ ਕਰ ਰਹੇ ਹਾਂ ਅਤੇ ਪੰਜਾਬੀ ਦੇ ਜਿਹੜੇ ਸ਼ਬਦ ਹਨ ਉਹ ਕਾਫ਼ੀ ਆਪਣਾਪਨ ਅਤੇ ਸਰਲ ਸ਼ਬਦ ਹੁੰਦੇ ਹਨ ਪੰਜਾਬੀ ਦੇ ਜਿਹੜੇ ਇੱਕ ਆਮ ਇਨਸਾਨ ਦੀ ਸਮਝ 'ਚ ਵੀ ਬੜੇ ਆਰਾਮ ਦੇ ਨਾਲ਼ ਆ ਜਾਂਦੇ ਹਨ ਅਤੇ ਹਰ ਇੱਕ ਭਾਸ਼ਾ ਦਾ ਅਲੱਗ ਅਲੱਗ ਰੂਪ ਹੁੰਦਾ ਹੈ ਅਲੱਗ ਅਲੱਗ ਤਰੀਕੇ ਨਾਲ਼ ਬੋਲੀ ਜਾਂਦੀ ਹੈ ਅਤੇ ਜੋ ਸਾਡੀ ਮਾਤ ਭਾਸ਼ਾ ਹੈ ਸਾਡੀ ਮਾਂ ਬੋਲੀ ਹੈ ਸਾਨੂੰ ਤਾਂ ਉਹਨੂੰ ਬੋਲਣਾ ਚੰਗਾ ਲੱਗਦਾ ਅਤੇ ਸਾਨੂੰ ਇਹ 'ਤੇ ਮਾਨ ਹੈ